ਹਾਂਜੀ ਦੇਖੋ ਜੀ ਪਹਿਲੇ ਨਾਲੋਂ ਹੁਣ ਜਿਹੜਾ ਸਮਾਂ ਜੀ ਬਹੁਤ ਬਦਲ ਗਿਆ ਸੱਭਿਆਚਾਰ ਵੀ ਜਿਹੜਾ ਪ੍ਰੋਗਰਾਮ ਸੀ ਉਹ ਬਹੁਤ ਹੀ ਵਧੀਆ ਪ੍ਰੋਗਰਾਮ ਸੀ ਜਿਹਦੇ ਵਿੱਚੋਂ ਪੁਰਾਣੇ ਗਾਇਕ ਪੁਰਾਣੇ ਚੀਜ਼ਾਂ ਜਿਸ ਤਰ੍ਹਾਂ ਅਸੀਂ ਘਰ 'ਚ ਚੁੱਲ੍ਹਾ ਜਲਾਉਂਦੇ ਸੀ ਆਪਾਂ ਬੂਰੇ ਦੇ ਉਹ ਚਲਾਉਂਦੇ ਸੀ ਉਹ ਲੱਕੜਾਂ ਜਲਾਉਂਦੇ ਸੀ ਜਿਹਦੇ ਨਾਲ ਚੁੱਲ੍ਹਿਆਂ 'ਤੇ ਬਹੁਤ ਹੀ ਚੀਜ਼ਾਂ ਵਧੀਆ ਬਣਦੀਆਂ ਸੀ ਔਰ ਬਾ ਬੜਾ ਪਿਆਰ ਮੁਹੱਬਤ ਸੀ ਲੇਕਿਨ ਹੁਣ ਗੈਸਾਂ ਔਰ ਕਈ ਚੀਜ਼ ਦੀਆਂ ਐਸੀਆਂ ਚੀਜ਼ਾਂ ਆ ਗਈਆਂ ਜਿਹਦੇ ਨਾਲ ਕਾਫੀ ਬਦਲਾਵ ਆਇਆ ਜੀ ਜਿਹਦੇ ਵਿੱਚੋਂ ਜਿਹੜੇ ਸਾਡੇ ਪੁਰਾਣੇ ਸੱਭਿਆਚਾਰ ਚੀਜ਼ਾਂ ਹੀ ਭੰਗੜਾ ਹੀ ਗਿੱਧੇ ਹੀ ਬੋਲੀਆਂ ਹੀ ਇਹ ਇਹ ਪਹਿਲੇ ਜਿੰਨੇ ਵੀ ਗਾਇਕ ਸੀ ਇਹ ਸੁਣਨ ਨੂੰ ਮਿਲਦਾ ਸੀ ਲੇਕਿਨ ਹੁਣ ਕੋਈ ਵੀ ਐਸਾ ਪ੍ਰੋਗਰਾਮ ਨਹੀਂ ਆਉਂਦਾ ਜਿਹੜਾ ਕਿ ਸਾਨੂੰ ਮਿਲੇ ਲੇਕਿਨ ਫਿਰ ਵੀ ਪੰਜਾਬੀ ਚੈਨਲ 'ਤੇ ਪੁਰਾਣੇ ਗਾਇਕ ਦੇ ਜਿਹੜੇ ਰਿਕਾਰਡ ਨੇ ਉਹ ਫੇਰ ਵੀ ਸਾਨੂੰ ਕਈ ਪ੍ਰੋਗਰਾਮ ਐਸੇ ਸੁਣਨ ਨੂੰ ਮਿਲਦੇ ਨੇ ਸੱਭਿਆਚਾਰ ਸਟੋਰੀਆਂ ਸੱਭਿਆਚਾਰ ਪ੍ਰੋਗਰਾਮ ਦੇਖਣ ਨੂੰ ਮਿਲਦੇ ਨੇ ਜਿਹੜੇ ਵੀ ਦਿਲ ਨੂੰ ਬਹੁਤ ਹੀ ਵਧੀਆ ਔਰ ਸੋਹਣੇ ਲੱਗਦੇ ਨੇ ਲੇਕਿਨ ਆਇਸਤਾ ਆਸਤਾ ਸਮੇਂ ਦੇ ਨਾਲ ਹਰ ਚੀਜ਼ ਬਦਲਦੀ ਜਾ ਰਹੀ ਹੈ ਔਰ ਕਾਫੀ ਫਰਕ ਪਿਆ ਲੇਕਿਨ ਪਹਿਲੇ ਵਰਗਾ ਸਮਾਂ ਨਹੀਂ ਰਿਹਾ